ਹੈਲੋ ਡਰਾਈਵਰ ਉਹ ਮੈਂ ਤੈਨੂੰ ਦੱਸਣਾ ਭੁੱਲ ਗਿਆ ਉਹ ਜਿਹੜੀ ਥਾਂ ਦੇ ਉੱਤੇ ਤੈਨੂੰ ਮੈਂ ਬੁਲਾਇਆ ਸੀ ਨਾ ਬਠਿੰਡਾ ਦੇ ਵਿੱਚ ਉੱਥੇ ਲੱਕੜ ਬਜ਼ਾਰ ਦੇ ਵਿੱਚ ਉਹ ਯਾਰ ਉੱਥੇ ਨਾ ਆਵੀ ਤੁਸੀਂ ਇੱਦਾਂ ਕਰਿਓ ਬਠਿੰਡਾ ਦੇ ਨਾਲ ਹੀ ਜਿਹੜਾ ਇੱਕ ਉਹ ਨੀਗਾ ਭੁੱਚੋ ਮੰਡੀ ਉੱਥੇ ਇੱਕ ਆਊਟਲੈਟ ਬਣਿਆ ਹੋਇਆ ਤੁਸੀਂ ਉੱਥੇ ਆ ਜਾਓ ਕਿਰਪਾ ਕਰਕੇ ਉੱਥੇ ਮੈਨੂੰ ਲੈਣ ਆ ਜਾਓ